ਭੰਗੜਾ ਪੰਜਾਬੀ ਗੱਭਰੂਆਂ ਦਾ ਨਾਚ ਹੈ ਬੇਦੀ ਹਾਥੀ ਜਲ ਭੰਗੜੇ ਦੇ ਆਮ ਸਟੈਪ ਹਨ ਭੰਗੜਾ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ ਹੱਥਾਂ ਦਾ ਹੁਲਾਰਾ ਦੇ ਕੇ ਭੰਗੜਾ ਪਾਇਆ ਜਾਂਦਾ ਹੈ ਭੰਗੜੇ ਵਿੱਚ ਆਮ ਤੌਰ 'ਤੇ ਬੱਲੇ ਬੱਲੇ ਅਸ਼ਕੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ